ਮੈਂ ਪਹਿਲਾਂ ਪੜ੍ਹਾਈ ਟਿਊਸ਼ਨਾ 'ਤੇ ਜਾ ਕੇ ਕਰਦਾ ਸੀ ਪ੍ਰੰਤੂ ਅੱਜ ਕੱਲ੍ਹ ਟੈਕਨੋਲਜੀ ਦਾ ਯੁੱਗ ਹੋਣ ਕਾਰਨ

ਇਹ ਪੜ੍ਹਾਈ ਆਨਲਾਈਨ ਕਲਾਸਾਂ ਦੁਆਰਾ ਅਲੱਗ ਅਲੱਗ ਪਲੇਟਫਾਰਮ ਜਿਵੇਂ ਬਾਏਜੂਸ ਵਿਦੰਤੂ ਵਰਗੇ ਪਲੈਟਫਾਰਮਾਂ ਤੋਂ ਪੜ੍ਹਾਈ ਕਰ ਸਕਦਾ ਹਾਂ ਇਸ ਟੈਕਨੋਲਜੀ ਨੇ ਸਾਡੇ ਜੀਵਨ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਹੈ ਇਸ ਟੈਕਨੋਲਜੀ ਨਾਲ ਹੋਰ ਵੀ ਕਈ ਕੰਮ ਕੀਤੇ ਜਾ ਸਕਦੇ ਹਨ ਅੱਜ ਜਿਵੇਂ ਆਰਟੀਫਿਸ਼ਅਲ ਇੰਟੈਲੀਜੈਂਸੀ ਦਾ ਦੌਰ ਚੱਲ ਰਿਹਾ ਹੈ ਇਸ ਨਾਲ ਅਸੀਂ ਕੋਈ ਵੀ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਾਂ